ਜੇਕਰ ਮੈਂ ਪੌਦਿਆਂ ਬਾਰੇ ਗੱਲ ਕਰਾਂ ਤਾਂ ਮੈਨੂੰ ਹਰੇਕ ਕਿਸਮ ਦੇ ਪੌਦੇ ਉਗਾਉਣੇ ਪਸੰਦ ਹਨ ਮੇਰੇ ਘਰ ਵਿੱਚ ਇੱਕ ਛੋਟਾ ਜਿਹਾ ਗਾਰਡਨ ਹੈ ਜਿੱਥੇ ਮੇਨੇ ਕਈ ਕਿਸਮ ਦੇ ਪੌਦੇ ਉਗਾਏ ਹੋਏ ਹਨ ਜਿਵੇਂ ਕਿ ਫੁੱਲ ਫਲ ਜਾਂ ਸਬਜ਼ੀਆਂ ਮੈਨੇ ਤਿੰਨੇ ਤਰ੍ਹਾਂ ਦੇ ਪੌਦੇ ਉਗਾਏ ਹੋਏ ਹਨ ਵੈਸੇ ਮੇਨੇ ਫੁੱਲ ਜ਼ਿਆਦਾ ਉਗਾਏ ਹੋਏ ਹਨ ਮੇਰੇ ਗਾਰਡਨ ਵਿੱਚ ਜਿਵੇਂ ਕਿ ਰੋਜ਼ ਲੀਲੀ ਫਲਾਵਰ ਹੀਬਿਸਕਸ ਮੈਨੂੰ ਬਹੁਤ ਸਾਰੇ ਫਲਾਵਰ ਉਗਾਉਣੇ ਪਸੰਦ ਹਨ ਮੇਰੇ ਘਰ ਮੇਰੇ ਗਾਰਡਨ ਵਿੱਚ ਫਲ ਵੀ ਉੱਗੇ ਹਨ ਜਿਵੇਂ ਕਿ ਸੇਬ ਸੰਤਰਾ ਮੈਨੂੰ ਮੈਨੇ ਸਬਜ਼ੀਆਂ ਵੀ ਬਹੁਤ ਸਾਰੀਆਂ ਉਗਾਈਆਂ ਹਨ ਮੈਨੂੰ ਇਹ ਤਿੰਨੋਂ ਚੀਜ਼ਾਂ ਆਪਣੇ ਗਾਰਡਨ ਵਿੱਚ ਬਹੁਤ ਸੁੰਦਰ ਲੱਗਦੀਆਂ ਹਨ ਅਤੇ ਵੈਸੇ ਮੈਂ ਜੇ ਆਪਣੀ ਰਾਏ ਬਾਰੇ ਜੇ ਮੈਂ ਆਪਣੀ ਪਸੰਦ ਬਾਰੇ ਗੱਲ ਕਰਾਂ ਤਾਂ ਮੈਨੂੰ ਫੁੱਲ ਉਗਾਉਣੇ ਜ਼ਿਆਦਾ ਪਸੰਦ ਹਨ ਮੇਰੇ ਗਾਰਡਨ ਵਿੱਚ ਜ਼ਿਆਦਾਤਰ ਫੁੱਲ ਹੀ ਉੱਗੇ ਹੋਏ ਹਨ ਮੈਨੂੰ ਜ਼ਿਆਦਾ ਪ ਜ਼ਿਆਦਾਤਰ ਮੈਂ ਆਪਣੇ ਗਾਰਡਨ ਵਿੱਚ ਫੁੱਲ ਉਗਾਏ ਹਨ ਜਿਨ੍ਹਾਂ ਨਾਲ ਮੇਰੇ ਗਾਰਡਨ ਵਿੱਚ ਮੇਰਾ ਗਾਰਡਨ ਬਹੁਤ ਹੀ ਚੰਗਾ ਲੱਗਦਾ ਹੈ ਅਤੇ ਮੇਰਾ ਗਾਰਡਨ ਹਰਿਆ ਭਰਿਆ ਲੱਗਦਾ ਹੈ ਅਤੇ ਰੰਗ ਬਿਰੰਗਾ ਵੀ ਲੱਗਦਾ ਹੈ ਜਿਸ ਨਾਲ ਕੋਈ ਵੀ ਮੇਰੇ ਗਾਰਡਨ ਨੂੰ ਦੇਖਦਾ ਹੈ ਤਾਂ ਬਹੁਤ ਹੀ ਜ਼ਿਆਦਾ ਆਗਰਸ਼ ਆਕਰਸ਼ਿਤ ਹੁੰਦਾ ਹੈ ਅਤੇ ਮੈਨੂੰ ਕਈ ਲੋਕ ਪੁੱਛਦੇ ਹਨ ਵੀ ਤੁਸੀਂ ਕਿਸ ਕਿਸਮ ਦੇ ਫੁੱਲ ਉਗਾਏ ਹੋਏ ਹਨ